ਸਤਿ ਸ਼੍ਰੀ ਅਕਾਲ ਮੈਂ ਵਿਆਹ ਦੇ ਪ੍ਰਤੀ ਜਿਹੜੇ ਦਾਜ ਦਿੱਤਾ ਜਾਂਦਾ ਜਾਂ ਕਿਸੇ ਨੂੰ ਕੁੜੀ ਨੂੰ ਸ਼ਗਨ ਪਾਏ ਜਾਂਦੇ ਨੇ ਵਿਆਹ 'ਤੇ ਸ ਟਾਈਮ 'ਤੇ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਪੁਰਾਣੇ ਜਮਾਨੇ ਦਾ ਵੀ ਅਤੇ ਨਵੇਂ ਜਮਾਨੇ ਦਾ ਵੀ ਮੇਰੀਆਂ ਦੋ ਬੇਟੀਆਂ ਨੇ ਮੇਰੀ ਫੈਮਲੀ ਦੇ ਵਿੱਚ ਦੋ ਭਾਬੀਆਂ ਆਈਆਂ ਹੋਈਆਂ ਇੱਕ ਨਵੇਂ ਟਾਈਮ ਦੀ ਆਈ ਹੋਈ ਹੈ ਇੱਕ ਪੁਰਾਣੇ ਪਿੰਡ ਤੋਂ ਆਈ ਹੋਈ ਆ ਉਸ ਤੋਂ ਬਾਅਦ ਯਾਨੀ ਕਿ ਮੈਨੂੰ ਆਪਣੀ ਨਾ ਭਾਬੀ ਜਦੋਂ ਮੈਂ ਅਸੀਂ ਆ ਛੋਟੇ ਸੀਗੇ ਜਦੋਂ ਸਾਡੇ ਭਾਬੀ ਜੀ ਵੀਰੇ ਦਾ ਵਿਆਹ ਹੋਇਆ ਸੀਗਾ ਅਤੇ ਉਹ ਦਾਜ ਲੈ ਕੇ ਆਏ ਉਹਨਾਂ ਉਹਨਾਂ ਦਾ ਵਿਆਹ ਸੀਗਾ ਜਦੋਂ ਅਸੀਂ ਉਹਨਾਂ ਨੂੰ ਵਿਆਹ ਦੇ ਵਿੱਚ ਦੇਖਿਆ ਕਿ ਉਹ ਪਿੰਡ ਦੇ ਵਿੱਚ ਹੀ ਵਿਆਹ ਹੋ ਰਿਹਾ ਸੀਗਾ ਆਪਣੇ ਘਰ ਚ ਹੀ ਘਰ ਦੇ ਵਿੱਚ ਹੋਣ ਦੇ ਬਾਵਜੂਦ ਵੀ ਵਿਆਹ ਬਹੁਤ ਵਧੀਆ ਸੀਗਾ ਮਤਲਬ ਪਿੰਡ ਦੇ ਬੜੇ ਬੰਦੇ ਖੁਸ਼ ਫੈਮਿਲੀ ਖੁਸ਼ ਉਹ ਜਦੋਂ ਉਹਨਾਂ ਦੇ ਲਾਵਾਂ ਫੇਰਿਆਂ ਤੋਂ ਬਾਅਦ ਉਹ ਦਾ ਬੈਠੇ ਆਪਣੀਆਂ ਚੇਅਰਸ ਉਦੋਂ ਚੇਅਰਸ ਹੀ ਹੁੰਦੀਆਂ ਸੀ ਕੋਈ ਪੈਲਸ ਨਹੀਂ ਹੁੰਦਾ ਸੀ ਚੇਅਰਸ 'ਤੇ ਬੈਠ ਅ ਕੁਰਸੀਆਂ 'ਤੇ ਬੈਠੇ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਸ਼ਗਨ ਦੇਣ ਲੱਗੇ ਉਦੋਂ ਪਿੰਡਾਂ 'ਚ ਰਿਵਾਜ ਹੁੰਦਾ ਸੀਗਾ ਕਿ ਅਗਲੇ ਨੇੇ ਓਦਾਂ ਹੀ ਬ ਕੋਈ ਲਿਫਾਫਿਆ 'ਚ ਨਹੀਂ ਪਾਉਂਦਾ ਸੀ ਦਸ ਦਸ ਰੁਪਏ ਵੀ ਦੇ ਦਿੰਦੇ ਸੀ ਅਗਲਾ ਪੰਜਾਹ ਵੀ ਦੇ ਦਿੰਦਾ ਸੀ ਮਤਲਬ ਜਦੋਂ ਅਸੀਂ ਆਪਣੀ ਭਾਬੀ ਨੂੰ ਘਰ ਲੈ ਕੇ ਆਏ ਘਰ ਲੈ ਕੇ ਆਏ ਉਹਨਾਂ ਦੀ ਪੇਟੀ ਮੈਂ ਖੋਲ੍ਹੀ ਭਾ ਓਦੋਂ ਓਦੋਂ ਪੇਟੀ ਦੀ ਪੇਟ ਖੁ ਪੇਟੀ ਖੁਲਾਈ ਨਣਾਨਾ ਨੂੰ ਦਿੱਤੀ ਜਾਂਦੀ ਸੀ ਨਣਾਨਾ ਨੂੰ ਦਿੱਤੀ ਜਾਂਦੀ ਸੀ ਉਹਦੇ ਵਿੱਚ ਨਣਾਨ ਦਾ ਇੱਕ ਪੇਟੀ 'ਚ ਸੂਟ ਹੁੰਦਾ ਸੀਗਾ ਮੈਨੂੰ ਬੜਾ ਹੁੰਦਾ ਸੀਗਾ ਕਿ ਮੈਨੂੰ ਉਹ ਸੂਟ ਮਿਲਣਾ ਚਾਹੀਦਾ ਅਤੇ ਮੈਂ ਆਪਣੀ ਪੇਟੀ ਆਪਣੀ ਭਾਬੀ ਦੀ ਖੋਲ੍ਹੀ ਖੋਲ੍ਹੀ ਉਹਦੇ ਵਿੱਚ ਮੈਨੂੰ ਉਹਨਾਂ ਦੇ ਹੱਥ ਦੇ ਕੱਢੀਆਂ ਵੀਆਂ ਚਾਦਰਾਂ ਸਿਰਹਾਣੇ ਅਤੇ ਮਤਲਬ ਦਰੀਆਂ ਵਗੈਰਾ ਸਾਰਾ ਕੁਝ ਮੈਨੂੰ ਦੇਖਣ ਨੂੰ ਮਿਲਿਆ ਛੋਟੇ ਛੋਟੇ ਸਮਾਨ ਵੀ ਮਿਲਿਆ ਜਿਹੜਾ ਆਪਾਂ ਆਮ ਕਿਚਨ 'ਚ ਵਰਤਿਆ ਅਤੇ ਉਹਨੂੰ ਦਾਜ ਕਿਹਾ ਜਾਂਦਾ ਉਹਨਾਂ ਨੇ ਆਪਣੀ ਫੈਮ ਉਹਨਾਂ ਦੇ ਮਾਪਿਆਂ ਨੇ ਉਹਨੂੰ ਦਾਜ ਦੇ ਤਾ ਪਰ ਮੇਰੇ ਅਸੀਂ ਪਸੰਦ ਨਹੀਂ ਕਰਦੇ ਸੀ ਦਾਜ ਲੈਣਾ ਠੀਕ ਉਸ ਤੋਂ ਬਾਅਦ ਯਾਨੀ ਕਿ ਆਂ ਮੇਰੇ ਯਾਨੀ ਕਿ ਭਾਬੀ ਜੀ ਨੇ ਸਾਡੇ ਜਦੋਂ ਅਸੀਂ ਆਪ ਵੱਡੀਆਂ ਹੋਈਆਂ ਸਾਡੇ ਭਾਬੀ ਸਾਡੇ ਮੰਮੀ ਨਹੀਂ ਸੀਗੇ ਮਤਲਬ ਸਾਡੇ ਭਾਬੀ ਨੇ ਸਾਡਾ ਸਾਰਾ ਕੁਛ ਕੀਤਾ ਉਸ ਜਦੋਂ ਕੀਤਾ ਤਾਂ ਉਹਨਾਂ ਨੇ ਥੋੜ੍ਹਾ ਥੋੜ੍ਹਾ ਜਦੋਂ ਆਪ ਪਤਾ ਲੱਗਿਆ ਕਿ ਬੱਚੇ ਹੁਣ ਵਿਆਹੁਣ ਵਾਲੇ ਆ ਕੁੜੀਆਂ ਵਿਆਹੁਣ ਵਾਲੀਆਂ ਤਾਂ ਉਹਨਾਂ ਨੇ ਥੋੜ੍ਹਾ ਥੋੜ੍ਹਾ ਕੁਛ ਲੈ ਕੇ ਨਾ ਤਿਆਰ ਕਰਨਾ ਸ਼ੁਰੂ ਕਰ ਤਾ ਦਰੀਆਂ ਬਣਾਉਣੀਆਂ ਖੇਸ ਬਣਾਉਣੇ ਇਸ ਤਰਾਂ ਸ਼ੁਰੂ ਕਰ ਲਿਆ ਜਦੋਂ ਇਸ ਤਰਾਂ ਸ਼ੁਰੂ ਕਰ ਲਿਆ ਉਸ ਸਮੇਂ ਫਿਰ ਮੇਰੇ ਪਾਪਾ ਨੇ ਡੈਡੀ ਨੇ ਮੇਰੇ ਨੇ ਸਾਨੂੰ ਵਿਆਹੁਣ ਦਾ ਯਾਨੀ ਕਿ ਟਾਈਮ ਆਇਆ ਅਤੇ ਮੇਰਾ ਵਿਆਹ ਉਸ ਟਾਮ ਉਸ ਟਾਈਮ 'ਤੇ ਨਵੇਂ ਟਾਈਮ ਦਾ ਸੀਗਾ ਨਵੇਂ ਟਾਈਮ ਦਾ ਸੀ ਕਿਉਂਕਿ ਓਦੋਂ ਕੂਲਰ ਫਰਿੱਜ ਸਾਰਾ ਕੁਛ ਦੇ ਦਿੰਦੇ ਸੀਗੇ ਅਤੇ ਟੀ ਵੀ ਟੁਵੀ ਵਗੈਰਾ ਬੈੱਡ ਅਲਮਾਰੀਆਂ ਸਭ ਕੁਛ ਦਿੰਦੇ ਸੀ ਮੇਰੇ ਵੀ ਪੇਟੀ ਦੇ ਵਿੱਚ ਭਾਬੀ ਨੇ ਬੜਾ ਸੋਹਣਾ ਸਮਾਨ ਪਾ ਕੇ ਦਿੱਤਾ ਉਹਨਾਂ ਨਾਲੋਂ ਯਾਨੀ ਕਿ ਅਲੱਗ ਸੀਗਾ ਉਹ ਪਹਿਲਾਂ ਪਿੰਡ ਦੇ ਤੌਰ ਦੇ ਮੁਤਾਬਕ ਸੀ ਮੇਰਾ ਸ਼ਹਿਰ ਦੇ ਮੁਤਾਬਕ ਸੀਗਾ ਅਤੇ ਜਦੋਂ ਸਾਡਾ ਯਾਨੀ ਕਿ ਵਿਆਹ ਹੋਇਆ ਸਾਡਾ ਵੀ ਉਸ ਟਾਈਮ ਖੈਰ ਘਰ ਹੀ ਸੀਗਾ ਜਦੋਂ ਘਰ ਸੀਗਾ ਅਤੇ ਉਸ ਤੋਂ ਬਾਅਦ ਯਾਨੀ ਕਿ ਸਾਨੂੰ ਜਦੋਂ ਸ਼ਗਨ ਪਾਏ ਗਏ ਅਸੀਂ ਚੇਅਰਸ 'ਤੇ ਬੈਠੇ ਸਾਨੂੰ ਸ਼ਗਨ ਪਾਏ ਗਏ ਉਦੋਂ ਸਾਨੂੰ ਥੋੜ੍ਹਾ ਜਿਹਾ ਯਾਨੀ ਕਿ ਆਪਾਂ ਪੰਜ ਸੌ 'ਤੇ ਚੱਲ ਪਿਆ ਹਜ਼ਾਰ 'ਤੇ ਚੱਲ ਪਿਆ ਗਿਆਰਾਂ ਸੌ 'ਤੇ ਮੇਰੀ ਪੇਟੀ 'ਚ ਵੀ ਯਾਨੀ ਕਿ ਇੱਦਾਂ ਦਾ ਹੀ ਸਮਾਨ ਮੇਰੀ ਭਾਬੀ ਨੇ ਪਾ ਤਾ ਸੀ ਉਸ ਤੋਂ ਬਾਅਦ ਜਦੋਂ ਅਸੀਂ ਆਪ ਫਿਰ ਮੈਨੂੰ ਹੋਰ ਜ਼ਿਆਦਾ ਵਧੀਆ ਲੱਗਿਆ ਅਤੇ ਚੰਗਾ ਵੀ ਲੱਗਿਆ ਅਤੇ ਗਲਤ ਵੀ ਲੱਗਿਆ ਕਿਉਂਕਿ ਮੇਰੇ ਅਗਾਂਹ ਆ ਕੇ ਦੋ ਬੇਟੀਆਂ ਹੋ ਗਈਆਂ ਬੇਟੀਆਂ ਹੋ ਗਈਆਂ ਇਸ ਤੋਂ ਬਾਅਦ ਯਾਨੀ ਕਿ ਹੁਣ ਮੈਨੂੰ ਸੋਚ ਲੱਗੀ ਹੋਈ ਆ ਕਿ ਮੈਂ ਆਪਣੀਆਂ ਬੇਟੀਆਂ ਦਾ ਕਿਵੇਂ ਕਰਾਂ ਕਿ ਉਸ ਟਾਈਮ ਤਾਂ ਆਪਾਂ ਪਾਪਾ ਡੈਡੀ ਦੇ ਮੁਤਾਬਿਕ ਸੀ ਕੰਮ ਹੁਣ ਆਪਣੇ ਸਿਰ 'ਤੇ ਜ਼ਿੰਮੇਵਾਰੀ ਪਈ ਹੋਈ ਆ ਕਿ ਮੈਂ ਉਹਨੂੰ ਸੋਨਾ ਬਣਾਵਾਂ ਕਿਉਂਕਿ ਅੱਜ ਕੱਲ੍ਹ ਮਹਿੰਗਾਈ ਹੋਈ ਇੰਨੀ ਹੋ ਗਈ ਆ ਕਿ ਆਪਾਂ ਬ ਆਪਣੇ ਵੱਸ ਤੋਂ ਬਾਹਰ ਹੋ ਜਾਂਦਾ ਕਿ ਇੰਨਾ ਇੱਕ ਨਾਲ ਇੱਕ ਕਮਾਉਣ ਵਾਲਾ ਹੋਵੇ ਫਿਰ ਸਹੀ ਰਹਿੰਦਾ ਕਿਉਂਕਿ ਮੈਂ ਸੋਨਾ ਵੀ ਬਣਾਉਣਾ ਉਹਨਾਂ ਦਾ ਦਾਜ ਵੀ ਬਣਾਉਣਾ ਅਤੇ ਉਸ ਮੈਨੂੰ ਹੁਣ ਇੰਝ ਲੱਗਦਾ ਕਿ ਜਦੋਂ ਹੁਣ ਜਿਹੜੇ ਹੁਣ ਵਾਲੇ ਵਿਆਹ ਹੋ ਗਏ ਉਹ ਪੈਲਸਾਂ 'ਚ ਕੀਤੇ ਜਾਂਦੇ ਆ ਮਹਿੰਗਾ ਮਹਿੰਗਾ ਵੀ ਪੈ ਜਾਂਦਾ ਕਿੰਨੇ ਕਿੰਨੇ ਖਰਚੇ ਹੋ ਜਾਂਦੇ ਆ ਮਾਂ ਪਿਓ ਤੋਂ ਵੱਸ ਤੋਂ ਬਾਹਰ ਹੋ ਜਾਂਦਾ ਜਦੋਂ ਮਾਂ ਪਿਓ ਤੋਂ ਵੱਸ ਤੋਂ ਬਾਹਰ ਹੋ ਜਾਂਦਾ ਫਿਰ ਬੱਚੇ ਸੋਚਦੇ ਆ ਕਿ ਹੁਣ ਅਸੀਂ ਆਪਣੇ ਮਾਪਿਆਂ ਨੂੰ ਕੀ ਕਰੀਏ ਕੀ ਇਨਾ ਉਹ ਵੀ ਨਹੀਂ ਬਰਦਾਸ਼ਤ ਕਰਦੇ ਉਹ ਵੀ ਬੜਾ ਮੁਸ਼ਕਿਲ ਨਾਲ ਤਿਆਰ ਕਰਦੇ ਆਪਣੇ ਆਪ ਨੂੰ ਦਿਮਾਗ ਆਪਣਾ ਬਣਾਉਂਦੇ ਆ ਅਤੇ ਚਲੋ ਫਿਰ ਵੀ ਨੂੰ ਕਰਨਾ ਪੈਂਦਾ ਦੁਨੀਆਦਾਰੀ ਨੂੰ ਨਿਭਾਉਣ ਵਾਸਤੇ ਕਿ ਉਸ ਤੋਂ ਜਦੋਂ ਉਹਨਾਂ ਨੇ ਹੁਣ ਸ਼ਗਨ ਪਾਏ ਜਾਂਦੇ ਆ ਉਹਨਾਂ ਦੇ ਜਿਹੜੇ ਕਲਾਸਮੇਟ ਹੁੰਦੀਆਂ ਨੇ ਆਪਣੀਆਂ ਸਹੇਲੀਆਂ ਹੁੰਦੀਆਂ ਨੇ ਉਹ ਯਾਨੀ ਕਿ ਆਪਣਾ ਗਿਫਟ ਲੈ ਕੇ ਆਉਂਦੀਆਂ ਕੋਈ ਕਰੋਕਰੀ ਦਾ ਕੋਈ ਬੈਡ ਸ਼ੀਟ ਵਗੈਰਾ ਜਾਂ ਕੁਛ ਇੱਦਾਂ ਦੇ ਉਹ ਲੈ ਆਉਂਦੀਆਂ ਜਿਹੜੇ ਯਾਨੀ ਕਿ ਰਿਸ਼ਤੇਦਾਰ ਹੁੰਦੇ ਆ ਉਹ ਪੈਸੇ ਪਾਉਂਦੇ ਆ ਪੈਸੇ ਮਤਲਬ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ ਅੱਗੇ ਨਾਲੋਂ ਅਤੇ ਉਹ ਜਿਹੜੇ ਪੈਸੇ ਆ ਮੈਨੂੰ ਤਾਂ ਇਹ ਮੇਰਾ ਤਾਂ ਇਹ ਹਿਸਾਬ ਆ ਕਿ ਹੁਣ ਜਦੋਂ ਵੀ ਆਪਾਂ ਕਿਸੇ ਦੇ ਧੀ ਦਾ ਵਿਆਹ ਕਰਦੇ ਹਾਂ ਉਹਨੂੰ ਸ਼ਗਨ ਪਾਉਣੇ ਚਾਹੀਦੇ ਆ ਥੋ ਚਲੋ ਉਹਨਾਂ ਉਹਨਾਂ ਦੇ ਜਿਹੜੇ ਬੈਂਕ ਬੈਲਸ ਬਣ ਜਾਵੇ ਜਿਹਨਾਂ ਦਾ ਉਹਨਾਂ ਨੇ ਹਿਸਾਬ ਨਾਲ ਬਣ ਜਾਵੇ ਪੈਸਾ ਉਹਨਾਂ ਦੇ ਕੰਮ ਆਊਗਾ ਹੁਣ ਜਿਹਨਾਂ ਨੇ ਯਾਨੀ ਕਿ ਜਿਹੜਾ ਇਹ ਦਾਜ ਆ ਦਾਜ ਵੀ ਗਲਤ ਆ ਲੈਣਾ ਵੀ ਗਲਤ ਆ ਅਤੇ ਦੇਣਾ ਵੀ ਇਸ ਟਾਈਮ ਗਲਤ ਹੈ ਕਿਉਂਕਿ ਦਾਜ ਨੂੰ ਇ ਇਹ ਦਾਜ ਪ੍ਰਥਾ ਬੰਦ ਕਰਨੀ ਚਾਹੀਦੀ ਆ ਕਿਉਂਕਿ ਜਿਹੜੇ ਗਰੀਬ ਆ ਉਹ ਅਮੀਰੀ ਨੂੰ ਦੇਖ ਕੇ ਅਮੀਰ ਨੂੰ ਦੇਖ ਕੇ ਉਹ ਆਪ ਟੈਨਸ਼ਨ 'ਚ ਪੈ ਜਾਂਦੇ ਆ ਗਲਤ ਉਹਨਾਂ ਦੇ ਵੀ ਦਿਮਾਗ 'ਤੇ ਬੋਝ ਬਹੁਤ ਪੈਂਦਾ ਕਿ ਅਸੀਂ ਹੁਣ ਇਹਨਾਂ ਨੇ ਉਹ ਮੁੰਡਾ ਵਧੀਆ ਮਿਲ ਗਿਆ ਹੁਣ ਸਾਨੂੰ ਉਹ ਵੀ ਦੇਣਾ ਪਊਗਾ ਬਰੋਬਰ ਕਰਨਾ ਪਊਗਾ ਇਸ ਥੈਂ ਸਤਿ ਸ਼੍ਰੀ ਅਕਾਲ ਜੀ